ਹੈਲੋ ਹਾਂਜੀ ਮੈਮ ਤੁਸੀਂ ਫ਼ੋਨ ਲਾਇਆ ਸੀ ਹਾਂਜੀ ਹਾਂਜੀ ਦੱਸ ਰਹੀ ਮੈਮ ਮੈਮ ਤੁਹਾਡਾ ਨਾਮ ਕੀ ਆ ਅੱਛਾ ਮੈਮ ਕਿਹੜਾ ਸਮਾਨ ਲੈਣਾ ਵੈਸੇ ਤੁਸੀਂ ਵਿਆਹ ਲਈ ਅੱਛਾ ਜੀ ਫੁਲਕਾਰੀਆਂ ਵਗੈਰਾ ਵੀ ਲੈਣੀਆਂ ਨੇ ਮੈਮ ਮੈਮ ਵੈਸੇ ਤਾਂ ਮਤਲਬ ਕਿ ਦੇਖ ਲਉ ਫੁਲਕਾਰੀਆਂ ਜੁੱਤੀਆਂ ਸੂਟ ਵਗੈਰਾ ਤਾਂ ਇੱਥੇ ਮਿਲ ਜਾਣਗੇ ਮਤਲਬ ਕਿ ਤੁਸੀਂ ਕਿਸ ਤਰੀਕੇ ਦੇ ਲੈਣੇ ਨੇ ਸੂਟ ਵਧੀਆ ਮਤਲਬ ਕਿ ਵਧੀਆ ਕੁਆਲਿਟੀ ਦੇ ਲੈਣੇ ਨੇ ਲੈਣ ਦੇਣ ਲਈ ਲੈਣੇ ਨੇ ਅੱਛਾ ਜੀ ਮੈਮ ਫਿਰ ਇੱਥੇ ਵਧੀਆ ਕੁਆਲਿਟੀ ਦਾ ਜੁੱਤੀਆਂ ਤਾਂ ਫੁੱਲਕਾਰੀਆਂ ਤਾਂ ਕਈ ਜਗ੍ਹਾ ਮਿਲਦੀਆਂ ਨੇ ਮਤਲਬ ਕਿ ਮਤਲਬ ਕਿ ਤੁਸੀਂ ਕਿ ਕਿਸ ਤਰੀਕੇ ਨਾਲ਼ ਲੈਣੇ ਨੇ ਕਿ ਜ਼ਿਆਦਾ ਵਰਾਇਟੀ ਹੋਣ ਜਿਹਦੇ 'ਚ ਜ਼ਿਆਦਾ ਦੇਖ ਸਕੀਏ ਜਾਂ ਮਤਲਬ ਕਿ ਜਿਹਦੇ ਵਿੱਚ ਦੋ ਤਿੰਨ ਹੀ ਪੀਸ ਹੋਣ ਬਸ ਸੇਮ ਸੇਮ ਅੱਛਾ ਜੀ ਮੈਮ ਇੱਥੇ ਤਾਂ ਵੈਸੇ ਹਲ ਮਤਲਬ ਕਿ ਪਟਿਆਲੇ ਇੱਕ ਨਾਭਾ ਚੌਂਕ ਹੈ ਪਟਿਆਲੇ ਜਦੋਂ ਆਪਾਂ ਜਾਂਦੇ ਹਾਂ ਤਾਂ ਇੱਕ ਨਾਭਾ ਚੌਂਕ ਹੈ ਉੱਥੇ ਜਿਹੜੀ ਉਹਦੇ ਨੇੜੇ ਤੇੜੇ ਸਾਰੀ ਮਾਰਕੀਟ ਸ਼ੋਪ ਵਗੈਰਾ ਨੇ ਉਹ ਸਾਰੇ ਹੀ ਇਹਦੇ ਲਈ ਫੇਮਸ ਨੇ ਪੰਜਾਬੀ ਜੁੱਤੀਆਂ ਲਈ ਕਿ ਜੇ ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਜੁੱਤੀ ਲੈਣਾ ਚਾਹੁੰਦੇ ਹੋ ਸਿੰਪਲ ਜੁੱਤੀ ਹੋ ਗਈ ਨਵੀਂ ਵਿਆਹੀ ਕੁੜੀ ਲਈ ਜੁੱਤੀ ਹੋ ਗਈ ਆਪਣਾ ਬਜ਼ੁਰਗਾਂ ਲਈ ਜੁੱਤੀ ਹੋ ਗਈ ਲੇਡੀਸ ਲਈ ਜੁੱਤੀ ਹੋ ਗਈ ਮੁੰਡਿਆਂ ਲਈ ਵੀ ਜੁੱਤੀਆਂ ਨੇ ਜਿਹੜੇ ਪੁਰਾਣੇ ਆਪਣੇ ਪੰਜਾਬ ਦੇ ਲੋਕ ਮੁੰਡੇ ਪਹਿਣਦੇ ਸੀ ਪਹਿਲਾਂ ਲੰਬੀ ਲੰਬੀ ਜੁੱਤੀਆਂ ਮਤਲਬ ਕਿ ਉਹ ਸਾਰੀ ਮੁੰਡਿਆਂ ਅਤੇ ਕੁੜੀਆਂ ਮਤਲਬ ਕੀ ਜਿੰਨੇ ਜਿੰਨੇ ਵੀ ਚਾਹੇ ਬੱਚਿਆਂ ਦੀ ਲੈਣੀ ਆ ਉੱਥੇ ਸਾਰੀ ਵਰਾਇਟੀ ਮਿਲ ਜਾਣਗੀਆਂ ਤੁਹਾਨੂੰ ਪਟਿਆਲੇ ਨਾਭਾ ਚੌਂਕ ਦੇ ਵਿੱਚ ਉ ਉੱਥੇ ਜਿਹੜੀ ਸਾਰੀ ਸ਼ੋਪਸ ਨੇ ਉਹ ਪੰਜਾਬੀ ਜੁੱਤੀਆਂ ਦੀ ਨੇ ਉੱਥੇ ਹਾਂਜੀ ਮੈਮ ਅਤੇ ਬਾਕੀ ਉੱਥੇ ਵਧੀਆ ਬਹੁਤ ਵਧੀਆ ਕੁਆਲਿਟੀ ਦਾ ਸਮਾਨ ਹੈ ਸਾਰਾ ਸਮਾਨ ਤੁਹਾਨੂੰ ਐਨ ਮਤਲਬ ਕਿ ਰੀਜਨੇਬਲ ਸਹੀ ਕੀਮਤ 'ਤੇ ਮਿਲ ਜੇਂਗੇ ਇੱਦਾਂ ਨਹੀਂ ਵੀ ਹਾਂ ਜ਼ਿਆਦਾ ਹੀ ਉਹਨਾਂ ਨੇ ਆਪਣੀ ਕੀਮਤ ਵੱਧ ਚੜ੍ਹਾ ਕੇ ਲਗ ਲਗਾ ਤੀ ਅਤੇ ਉਸ ਤੋਂ ਇਲਾਵਾ ਨਾ ਇਹ ਆਪਣਾ ਜਿਵੇਂ ਤੁਸੀਂ ਫੁਲਕਾਰੀਆਂ ਵਗੈਰਾ ਕਦੇ ਸੂਟ ਵਗੈਰਾ ਕਹਿ ਰਹੇ ਹੋ ਅਤੇ ਇਹ ਸਾਰਾ ਸਮਾਨ ਮਿਲੇਗਾ ਆਪਾਂ ਨੂੰ ਲੁਧਿਆਣਾ ਜਿਵੇਂ ਤੁਸੀਂ ਵਿਆਹ ਲਈ ਸਮਾਨ ਲੈਣਾ ਨਾ ਕਿ ਕਾਫ਼ੀ ਹੁਣ ਇੱਕ ਦੋ ਚੁ ਫੁਲਕਾਰੀ ਤਾਂ ਲੈਣੀ ਨਹੀਂ ਹੋਣੀ ਤੁਸੀਂ ਤੁਸੀਂ ਤਾਂ ਕਾਫ਼ੀ ਸਾਰੀ ਲੈਣੀਆਂ ਹੋਣੀਆਂ ਦਸ ਬਾਰ੍ਹਾਂ ਫੁਲਕਾਰੀਆਂ ਵਿਆਹ ਲਈ ਹਾਂ ਤਾਂ ਤੁਹਾਨੂੰ ਨਾ ਉੱਥੇ ਲੁਧਿਆਣੇ ਮਿਲ ਜਾਣਗੇ ਲੁਧਿਆਣੇ ਤੁਸੀਂ ਨਾ ਜਦੋਂ ਤੁਸੀਂ ਲੁਧਿਆਣੇ ਬੱਸ ਸਟੈਂਡ 'ਤੇ ਪਹੁੰਚੋਗੇ ਤਾਂ ਉੱਥੇ ਮੇਨ ਮਾਰਕੀਟ ਆ ਉੱਥੇ ਜਾ ਕੇ ਤੁਸੀਂ ਚਾਹੇ ਕਹਿ ਦਿਓ ਘੰਟਾ ਚੌਂਕ ਜਾਣਾ ਆ ਉਹ ਤੁਹਾਨੂੰ ਆਪਣਾ ਘੰਟਾ ਚੌਂਕ ਲੈ ਜਾਣਗੇ ਆਟੋ ਵਾਲੇ ਕੋਈ ਵੀ ਉੱਥੇ ਜਾ ਕੇ ਕਾਫ਼ੀ ਸਾਰੀ ਜਿਹੜੀ ਦੁਕਾਨਾਂ ਨੇ ਉਹ ਫੁਲਕਾਰੀਆਂ ਦੇ ਨੇ ਅਤੇ ਜੇ ਤੁਸੀਂ ਮਤਲਬ ਕਿ ਐਨ ਵਧੀਆ ਸਮਾਨ ਲੈਣਾ ਚਾਹੁੰਦੇ ਤਾਂ ਉੱਥੇ ਇੱਕ ਕਰਨ ਕਰਨ ਆਪਣਾ ਕਰਨ ਫੁਲਕਾਰੀ ਦੇ ਨਾਮ 'ਤੇ ਇੱਕ ਸ਼ੋਪ ਆ ਤੁਸੀਂ ਉੱਥੇ ਆ ਕੇ ਨਾ ਉਹਨਾਂ ਨੂੰ ਕਹਿ ਦਿਓ ਫੁਲਕਾਰੀ ਵਿਆਹ ਲਈ ਲੈਣੀਆਂ ਨੇ ਅਤੇ ਤੁਹਾਨੂੰ ਅਲੱਗ ਅਲੱਗ ਤਰੀਕੇ ਦੀ ਅਲੱਗ ਅਲੱਗ ਕਲਰ ਆਪਣਾ ਰੰਗਾਂ ਦੇ ਵਿੱਚ ਦਿਖਾ ਦੇਣਗੇ ਨਾਲ਼ ਹੀ ਉਹਦੇ ਜੁੱਤੀਆਂ ਦੀ ਵੀ ਦੁਕਾਨ ਹੈ ਉੱਥੋਂ ਲੈ ਲਿਓ ਚਾਹੇ ਹਾਂਜੀ ਹਾਂਜੀ ਚਾਹੇ ਲੁਧਿਆਣੇ ਦੇ ਲੈ ਲਿਓ ਤੁਸੀਂ ਲੁਧਿਆਣੇ ਵੈਸੇ ਜ਼ਿਆਦਾ ਬੈਸਟ ਹੈਗਾ ਕਿਉਂਕਿ ਤੁਹਾਨੂੰ ਉੱਥੇ ਜੁੱਤੀਆਂ ਅਤੇ ਫੁਲਕਾਰੀਆਂ ਸੂਟ ਵਗੈਰਾ ਤਿੰਨੇ ਚੀਜ਼ਾਂ ਇਕੱਠੀਆਂ ਮਿਲ ਜਾਣਗੀਆਂ ਜੇ ਤੁਸੀਂ ਜ਼ਿਆਦਾ ਵਰਾਇਟੀ ਚਾਹੁੰਦੇ ਹੋ ਤਾਂ ਤੁਸੀਂ ਪਟਿਆਲੇ ਤੋਂ ਜੁੱਤੀਆਂ ਲੈ ਲਿਓ ਅਤੇ ਆਪਣਾ ਲੁਧਿਆਣੇ ਤੋਂ ਫੁਲਕਾਰੀਆਂ ਵਗੈਰਾ ਲੈ ਲਿਓ ਹਾਂਜੀ ਬਾਕੀ ਇਹ ਜਗ੍ਹਾ ਨੇ ਮੈਮ ਵੈਸੇ ਤਾਂ ਫੇਮਸ ਜਿੱਥੇ ਤੁਹਾਨੂੰ ਵਧੀਆ ਮਿਲ ਜਾਣ ਗਾ ਸਾਰਾ ਸਮਾਨ ਹਾਂਜੀ ਓਕੇ ਜੀ